ਸਾਡੇ ਸਿੱਖ ਧਰਮ ਵਿੱਚ ਸਾਨੂੰ ਬਹੁਤ ਕੁਛ ਸਿਖਾਇਆ ਜਾਂਦਾ ਹੈ ਇਹ ਧਰਮ ਵਿੱਚ ਸਾਨੂੰ ਸਾਨੂੰ ਗੱਤਕਾ ਵੀ ਸਿਖਾਈਆਂ ਜਾਦੀਆਂ ਹਨ ਅਤੇ ਲੜਕੀਆਂ ਨੂੰ ਵੀ ਗੱਤਕਾ ਸਿਖਾਈਆਂ ਜਾਂਦੀਆਂ ਹਨ ਜਿਸ ਜਿਸ ਗੱਤਕਾ ਸਿੱਖਣ ਨਾਲ਼ ਲੜਕੀਆਂ ਆਪਣੀ ਸੁਰੱਖਿਆ ਆਪ ਕਰ ਸਕਦੀਆਂ ਹਨ ਮਾੜੇ ਚੰਗੇ ਕੰਮਾਂ ਵਿੱਚ ਅਤੇ ਇਸ ਵਿੱਚ ਸਾਨੂੰ ਨਸ਼ੇ ਪੱਤੇ ਤੋਂ ਵੀ ਰੋਕਿਆ ਜਾਂਦਾ ਹੈ ਜਿਸ ਨਾਲ਼ ਸਾਡਾ ਸਰੀਰ ਫਿੱਟ ਰਹਿੰਦਾ ਹੈ ਅਤੇ ਇਸ ਵਿੱਚ ਸਾਨੂੰ ਖੇਲਣੇ ਬਾਰੇ ਵੀ ਸਿਖਾਇਆ ਜਾਂਦਾ ਹੈ ਜੋ ਵੀ ਖੇਡ ਕਬੱਡੀ ਫੁੱਟਬਾਲ ਜੋ ਵੀ ਖੇਡ ਖੇਡ ਸਕਦੇ ਹਨ ਜਿਸ ਵਿੱਚ ਸਾਡਾ ਸਰੀਰ ਫਿੱਟ ਰਹਿੰਦਾ ਹੈ ਅਤੇ ਇਸ ਇਸ ਨੂੰ ਇਸ ਵਿੱਚ ਸਾਨੂੰ ਮਨ ਨੂੰ ਸ਼ਾਂਤੀ ਲਈ ਸਵੇਰੇ ਸ਼ਾਮ ਜਪੁਜੀ ਸਾਹਿਬ ਦਾ ਪਾਠ ਕਰਨ ਬਾਰੇ ਵੀ ਸਿਖਾਇਆ ਜਾਂਦਾ ਹੈ ਜਿਸ ਨਾਲ਼ ਸਾਡੇ ਸਰੀਰ ਨੂੰ ਸ਼ਾਂਤੀ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ